ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਅਸੀਂ ਟੀ ਕੋਫੀ ਸ਼ੋਪ ਤੋਂ ਬੋਲ ਰਹੇ ਹਾਂ ਹਾਂਜੀ ਓਕੇ ਸਾਡੇ ਕੋਲ ਹਾਂਜੀ ਅਵੇਲੇਬਲ ਹੈ ਗਰੀਨ ਟੀ ਲੈਮਨ ਟੀ ਕੌਫੀ ਵੀ ਹੈ ਹਾਂਜੀ ਨਾਰਮਲ ਵੀ ਹੈਗੀ ਕਿਹੜੀ ਚਾਹੀਦੀ ਤੁਹਾਨੂੰ ਓਕੇ ਹਾਂਜੀ ਕੋਲਡ ਕੌਫੀ ਹਾਂਜੀ ਕਿੰਨੇ ਕੱਪ ਹਾਂਜੀ ਹਾਂਜੀ ਠੀਕ ਹੈ ਜੀ ਕਿੱਥੇ ਭੇਜਣੇ ਹੈ ਜੀ ਕਿੱਥੇ ਭੇਜਣੇ ਨੇ ਠੀਕ ਹੈ ਜੀ ਹਾਂਜੀ ਭੇਜ ਦਿੰਦੇ ਹਾਂ ਕੋਲਡ ਕੌਫੀ ਦੇ ਪੰਦਰਾਂ ਕੱਪ ਅਤੇ ਹੋਰ ਕੀ ਚਾਹੀਦਾ ਗਰੀਨ ਟੀ ਉਹਦੇ ਕਿੰਨੇ ਕੱਪ ਠੀਕ ਹੈ ਜੀ ਹਾਂਜੀ ਕੌਫੀ ਹੈ ਆਪਣੇ ਫੋਟੀ ਪਰ ਕੱਪ ਥਰਟੀ ਫੋਟੀ ਪਰ ਕੱਪ ਤੁਹਾਨੂੰ ਲੈੱਸ ਹੋ ਜੇਗਾ ਅਗਰ ਤੁਸੀਂ ਪੰਦਰਾਂ ਲੈਂਦੇ ਹੋ ਨਾ ਹਾਂਜੀ ਓ ਚਾਹ ਦਾ ਨੋਰਮਲ ਟੈੱਨ ਰੁਪਏ ਕੱਪ ਟੈੱਨ ਰੁਪੀਸ ਸਮੋਲ ਆ ਅਗਰ ਲਾਰਜ ਲੈਣਾ ਤਾਂ ਟਵੈਂਟੀ ਰੁਪੀਸ ਹਾਂਜੀ ਟੈੱਨ ਰੁਪੀਸ ਨੋਰਮਲ ਛੋਟਾ ਕੱਪ ਹੈ ਸਮੋਲ ਅਤੇ ਵੀਹ ਰੁਪਏ ਦਾ ਆਪਣੇ ਵੱਡਾ ਕਿਹੜਾ ਚਾਹੀਦਾ ਤੁਹਾਨੂੰ ਠੀਕ ਹੈ ਦਸ ਰੁਪਏ ਪਰ ਕੱਪ ਆ ਪੰਦਰਾਂ ਹੈ ਨਾ ਹਾਂਜੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਵਧੀਆ ਆਏਗੀ ਅਤੇ ਤੁਸੀਂ ਤੁਹਾਨੂੰ ਪੰਦਰਾਂ ਵੀਹ ਮਿੰਨਟ ਤਾਂ ਲੱਗ ਜਾਣਗੇ ਸਾਡੇ ਹਾਂਜੀ ਸਾਡੇ ਜਿਹੜੇ ਵਰਕਰ ਨੇ ਇਹਨਾਂ ਕੋਲ ਆਲਰੇਡੀ ਕਾਫੀ ਔਡਰਸ ਨੇ ਅਗਰ ਹੋਰ ਵੀ ਕੁਛ ਚਾਹੀਦਾ ਤੁਹਾਨੂੰ ਔਡਰ ਕਰਨਾ ਨਾਲ ਸਨੈਕਸ ਵਗੈਰਾ ਅਵੇਲੇਬਲ ਨੇ ਬਿਸਕਿਟ ਵਗੈਰਾ ਹੋਰ ਵੀ ਕੁਛ ਚਾਹੀਦਾ ਤਾਂ ਤੁਸੀਂ ਦੱਸ ਸਕਦੇ ਹੋ ਓਕੇ ਸੈਂਡਵਿਚ ਕਿਹੜੀ ਚਾਹੀਦੀ ਹੈ ਗਰਿੱਲ ਜਾਂ ਚਿਲ ਗਰਿੱਲ ਵਾਲੀ ਚਾਹੀਦੀ ਹੈ ਜਾਂ ਨੋਰਮਲ ਜਿਹੜੀ ਆ ਠੰਡੀ ਵਾਲੀ ਚਿਲ ਠੀਕ ਹੈ ਜੀ ਠੀਕ ਹੈ ਸਾਨੂੰ ਤੁਸੀਂ ਐਡਰੈਸ ਆਪਣਾ ਭੇਜ ਦਿਓ ਅਸੀਂ ਤੁਹਾਡੇ ਅਡਰੈੱਸ 'ਤੇ ਟਾਈਮ ਨਾਲ ਔਡਰ ਸੈਂਡ ਕਰ ਦਾਂਗੇ ਭੇਜ ਦਾਂਗੇ ਹਾਂਜੀ ਅਤੇ ਹਾਂਜੀ ਹਾਂਜੀ ਭੇਜ ਹਾਂਜੀ ਭੇਜ ਦਾਂਗੇ ਹੋਰ ਕਿਸੇ ਨੇ ਕੁਛ ਮੰਗਵਾਉਣਾ ਹੋਵੇ ਤਾਂ ਹੈ ਨਾ ਦੱਸ ਦਿਓ ਫਿਰ ਆਰਡਰ ਵੀ ਡਿਲੇਅ ਨਹੀਂ ਹੋਵੇਗਾ ਤੁਹਾਡਾ ਟਾਈਮ 'ਤੇ ਤੁਹਾਨੂੰ ਤੁਹਾਡਾ ਓਕੇ ਓਕੇ ਓਕੇ ਜੀ ਥੈਂਕ ਯੂ